ਇੱਕ ਆਮ ਭੰਗੜਾ ਐਰੋਬਿਕ ਮੁਕਾਬਲੇ ਵਿੱਚ ਟੀਮਾਂ ਪੰਜਾਬੀ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਊਰਜਾ ਵਾਨ ਡਾਂਸ ਰੂਟੀਨ ਪੇਸ਼ ਕਰਦੀਆਂ ਹਨ ਮੁਕਾਬਲੇ ਵਿੱਚ ਆਮ ਤੌਰ 'ਤੇ ਸ਼ੈਲੀਆਂ ਅਤੇ ਹੁਨਰਾਂ ਦੀ ਇੱਕ ਸ਼੍ਰੇਣੀ ਨੂੰ ਪ੍ਰਦਰਸ਼ਿਤ ਕਰਨ ਲਈ ਕਈ ਸ਼੍ਰੇਣੀਆਂ ਸ਼ਾਮਲ ਹੁੰਦੀਆਂ ਹਨ ਮੁੱਖ ਸ਼੍ਰੇਣੀਆਂ ਵਿੱਚ ਸ਼ਾਮਲ ਹਨ ਰਵਾਇਤੀ ਭੰਗੜਾ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੇ ਹੋਏ ਕਲਾਸਿਕ ਡਾਂਸ ਮੂਵਜ ਅਤੇ ਪੋਸ਼ਾਕਾਂ 'ਤੇ ਫੋਕਸ ਫਿਊਜਨ ਭੰਗੜਾ ਰਵਾਇਤੀ ਭੰਗੜੇ ਨੂੰ ਹੋਰ ਡਾਂਸ ਸ਼ੈਲੀਆਂ ਜਾਂ ਸ਼ੈਲੀਆਂ ਦੇ ਤੱਤਾਂ ਨਾਲ ਜੋੜਦਾ ਹੈ ਰਚਨਾਤਮਕ ਜਾਂ ਸਮਕਾਲੀ ਭੰਗੜਾ ਨਵੀਨਤਾਕਾਰੀ ਕੋਰੀਓਗ੍ਰਾਫੀ ਅਤੇ ਆਧੁਨਿਕ ਵਿਆਖਿਆਵਾਂ 'ਤੇ ਜ਼ੋਰ ਦਿੰਦਾ ਹੈ ਇਕੱਲੇ ਪ੍ਰਦਰਸ਼ਨ ਵਿਅਕਤੀਗਤ ਡਾਂਸਰ ਆਪਣੀ ਨਿੱਜੀ ਸ਼ੈਲੀ ਤਕਨੀਕੀ ਹੁਨਰ ਨੂੰ ਉਜਾਗਰ ਕਰਨ ਲਈ ਇੱਕ ਰੂਟੀਨ ਪੇਸ਼ ਕਰਦੇ ਹਨ ਸਮੂਹ ਪ੍ਰਦਰਸ਼ਨ ਵੱਖ ਵੱਖ ਆਕਾਰਾਂ ਦੀਆਂ ਟੀਮਾਂ ਤਾਲਮੇਲਬੱਧ ਰੂਟੀਨ ਪੇਸ਼ ਕਰਦੀਆਂ ਹਨ ਟੀਮ ਵਰਕ ਅਤੇ ਸਮਕਾਲੀ ਕਰਨ ਦਾ ਪ੍ਰਦਰਸ਼ਨ ਕਰਦੀਆਂ ਹਨ ਜੱਜ ਤਕਨੀਕ ਸਿਰਜਾ ਸਿਰਜਨਾਤਮਕ ਤਾਂ ਊਰਜਾ ਅਤੇ ਭੰਗੜੇ ਦੀ ਭਾਵਨਾ ਦੀ

ਜਿਸ ਨਾਲ ਚੋਟੀ ਦੇ ਸਨਮਾਨਾਂ ਲਈ ਅੰਤਿਮ ਪ੍ਰਦਰਸ਼ਨ ਹੁੰਦਾ ਹੈ